ਮੈਂ ਰਾਜ ਕੁਮਾਰ ਗੁਰਦਾਸਪੁਰ ਦੇ ਜ਼ਿਲ੍ਹੇ ਦਾ ਰਹਿਣ ਵਾਲਾ ਹਾਂ ਜਿਵੇਂ ਕਿ ਪੰਜਾਬੀ ਭਾਸ਼ਾ ਦੀ ਖੇਤਰ ਵਿੱਚ ਗੱਲ ਕਰਦੇ ਹਾਂ ਕਿ ਪੰਜਾਬੀ ਪੰਜਾਬੀ ਪੰਜਾਬ ਦੀ ਸਰਕਾਰੀ ਭਾਸ਼ਾ ਪੰਜਾਬੀ ਪੰਜਾਬੀ 'ਚ ਕੰਮ ਕਰਨਾ ਪੰਜਾਬ ਵਿੱਚ ਸਾਰੇ ਕੰਮ ਪੰਜਾਬੀ ਵਿੱਚ ਹੋ ਰਹੇ ਹਨ ਜਿਵੇਂ ਕਿ ਕੋਈ ਸਰਕਾਰੀ ਕੰਮ ਜਾਂ ਬੱਸਾਂ ਅਤੇ ਦੁਕਾਨਾਂ ਦੇ ਬਾਹਰ ਵੀ ਕੁਝ ਲਿਖਿਆ ਹੈ ਤਾਂ ਉਹ ਪੰਜਾਬੀ ਵਿੱਚ ਲਿਖਿਆ ਹੁੰਦਾ ਹੈ ਪੰਜਾਬੀ ਸਾਰੇ ਇਲਾਕੇ ਵਿਚ ਵਿਖਰੀ ਹੋਈ ਹੈ ਹੁਣ ਤਾਂ ਸਰਕਾਰ ਨੇ ਵੀ ਇਹ ਜ਼ਰੂਰੀ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਪੰਜਾਬੀ ਬੋਲੋ ਪੰਜਾਬੀ ਲਿਖੋ ਪੰਜਾਬੀ ਪੜ੍ਹੋ ਅਤੇ ਜੇਕਰ ਇੱਕ ਪਾਸੇ ਅਸੀਂ ਬੰਗਾਲ ਦੀ ਗੱਲ ਕਰੀਏ ਤਾਂ ਕੁਝ ਲੋਕ ਉੱਥੇ ਵੀ ਪੰਜਾਬੀ ਦੇ ਸ਼ਬਦ ਯੂਜ ਕਰਦੇ ਹਨ